ਖੇਡਾਂ ਲੋਕਾਂ ਨੂੰ ਇਕੱਠਿਆਂ ਕਰਦੀਆਂ ਹਨ ਅਤੇ ਟੀਮ ਵਰਕ ਵੇਟ ਕਰਨ ਵਿੱਚ ਵੀ ਉਤਸਾਹਿਤ ਕਰਦੀਆਂ ਹਨ ਜਦੋਂ ਵੀ ਆਪਣੇ ਕਿਸੇ ਪਿੰਡ ਵਿੱਚ ਟੂਰਨਾਮੈਂਟ ਜਾਂ ਮੈਚ ਹੁੰਦਾ ਹੈ ਤਾਂ ਉਸ ਵਿੱਚ ਲੋਕ ਇਕੱਠੇ ਰਲ ਮਿਲ ਕੇ ਉਸ ਗੇਮ ਨੂੰ ਇੰਜੋਏ ਕਰਦੇ ਹਨ ਉਹਨਾਂ ਦਾ ਗੈਪ ਘੱਟਦਾ ਹੈ ਅਤੇ ਉਹ ਇੱਕ ਦੂਜੇ ਦੀ ਇੱਜ਼ਤ ਕਰਦੇ ਹਨ ਲੜਾਈ ਝਗੜੇ ਤੋਂ ਵੀ ਬਹੁਤ ਦੂਰ ਰਹਿੰਦੇ ਹਨ ਅਤੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ ਉਹਨਾਂ ਵਿੱਚ ਇੱਕ ਵਧੀਆ ਭਾਈਚਾਰਾ ਪੈਦਾ ਹੁੰਦਾ ਹੈ ਅਤੇ ਉਹਨਾਂ ਦਾ ਸੁਭਾਅ ਵੀ ਬਹੁਤ ਹੀ ਵਧੀਆ ਰਹਿੰਦਾ ਹੈ ਜੇ ਆਪਾਂ ਗੱਲ ਕਰੀਏ ਟੂਰਨਾਮੈਂਟ ਦੀ ਟੂਰਨਾਮੈਂਟ ਵਿੱਚ ਲੋਕ ਆਪਸ ਵਿੱਚ ਗੱਲਾਂ ਬਾਤਾਂ ਮਾਰ ਕੇ ਆਪਣਾ ਟਾਈਮ ਨੂੰ ਪਾਸ ਕਰਦੇ ਹਨ ਅਤੇ ਵਧੀਆ ਰਹਿੰਦੇ ਹਨ ਅਤੇ ਉਹਨਾਂ ਦੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਤੇ ਉਹਨਾਂ ਦਾ ਮਾਨਸਿਕ ਪੱਧਰ ਵੀ ਬਹੁਤ ਵਧੀਆ ਰਹਿੰਦਾ ਹੈ ਅਤੇ ਲੋਕਾਂ ਵਿੱਚ ਇਕੱਠੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਉਹਨਾਂ ਨੂੰ ਹੌਸਲਾ ਉਹਨਾਂ ਦਾ ਹੌਸਲਾ ਵੱਧਦਾ ਹੈ ਜੇ ਆਪਾਂ ਉਹਨਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹਨਾਂ ਦੇ ਸੁਭਾਅ ਵਿੱਚ ਵੀ ਕਾਫ਼ੀ ਵਧੀਆ ਪਨ ਆਉਂਦਾ ਹੈ